ਜੇਕਰ ਅਸੀਂ ਕਾਰੋਬਾਰ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਪੰਜਾਬ ਵਿੱਚ ਹਰ ਕੋਈ ਹੀ ਬਾਹਰ ਜਾਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ ਕੋਈ ਵੀ ਇੱਥੇ ਕੰਮ ਕਰਨਾ ਨਹੀਂ ਚਾਹ ਰਿਹਾ ਅਤੇ ਮੈਂ ਗੱਲ ਕਰ ਰਿਹਾ ਹਾਂ ਕਿ ਸਾਡੇ ਹੀ ਕੋਲ ਇੱਕ ਪਿੰਡ ਵਿੱਚ ਕਿਸੇ ਨੇ ਇੱਕ ਬਹੁਤ ਹੀ ਵੱਡੀ ਫੈਕਟਰੀ ਖੋਲ੍ਹੀ ਸੀ

ਉਸ ਦੀ ਫੈਕਟਰੀ ਖੋਲ੍ਹਣ ਨਾਲ ਪਿੰਡ ਦੇ ਬਹੁਤ ਹੀ ਨੌਜਵਾਨ ਜੋ ਕਿ ਸਾਰਾ ਦਿਨ ਹੀ ਇਸ ਤਰ੍ਹਾਂ ਵਿਹਲੇ ਤੁਰੇ ਫਿਰਦੇ ਸਨ ਜਿਹਨਾਂ ਕੋਲ ਕੋਈ ਰੁਜ਼ਗਾਰ ਨਹੀਂ ਸੀ ਅਤੇ ਖਾਣ ਨੂੰ ਰੋਟੀ ਵੀ ਨਹੀਂ ਜੁੜਦੀ ਸੀ ਔਰ ਉਹਨਾਂ ਨੂੰ ਵੀ ਰੁਜ਼ਗਾਰ ਮਿਲਿਆ ਅਤੇ ਉਹ ਵੀ ਅੱਜ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਹਨ ਸਾਨੂੰ ਇਸ ਚੀਜ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਸ ਕਿ ਅਸੀਂ ਇੱਥੇ ਰਹਿ ਕੇ ਵੀ ਬਹੁਤ ਵਧੀਆ ਕਾਰੋਬਾਰ ਕਰ ਸਕਦੇ ਹਾਂ ਬਹੁਤ ਵਧੀਆ ਕਮਾ ਸਕਦੇ ਹਾਂ ਇੱਥੇ ਇੱਕ ਬਹੁਤ ਹੀ ਵਧੀਆ ਜ਼ਿੰਦਗੀ ਜੀਅ ਸਕਦੇ ਹਾਂ ਹਰ ਕਿਸੇ ਸਾ ਸਾਨੂੰ ਬਾਕੀ ਲੋਕਾਂ ਵੱਲ ਦੇਖ ਕੇ ਬਾਹਰ ਜਾਣ ਦੀ ਦੌੜ ਵਿੱਚ ਨਹੀਂ ਲੱਗੇ ਰਹਿਣਾ ਚਾਹੀਦਾ ਸਾਨੂੰ ਇੱਥੇ ਵੀ ਆਪਣਾ ਕਾਰੋਬਾਰ ਕਰਨਾ ਚਾਹੀਦਾ ਹੈ